ਫੋਟੋਆਂ ਖਿੱਚਣ ਦਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ ਜਿਸ ਨੂੰ ਅੱਗੇ ਲਿਜਾਉਣ ਲਈ ਮੈਂ ਕਲਚਰਲ ਫੈਸਟੀਵਲ ਵਿੱਚ ਵੀ ਹਿੱਸਾ ਲਿੱਤਾ ਕਲਚਰਲ ਫੈਸਟੀਵਲ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਮੈਨੂੰ ਇੰਟਰਜ਼ੋਲਨ ਖੇਡਣ ਦਾ ਵੀ ਮੌਕਾ ਮਿਲਿਆ ਉਸ ਤੋਂ ਬਾਅਦ ਮੈਂ ਸਟੇਟ ਵਿੱਚ ਵੀ ਹਿੱਸਾ ਲਿਆ ਸਟੇਟ ਵਿੱਚ ਹਿੱਸਾ ਲੈਣ ਤੋਂ ਬਾਅਦ ਜਦੋਂ ਮੈਂ ਅੰਤਰਰਾਸ਼ਟਰੀ ਬਾਰੇ ਸੋਚਿਆ ਤਾਂ ਅੰਤਰਰਾਸ਼ਟਰੀ ਦੀ ਸਰਕਾਰੀ ਵੈਬਸਾਈਟ ਵਿੱਚ ਲੋਗਿਨ ਕਰਕੇ ਮੈਂ ਆਪਣੀਆਂ ਫੋਟੋਆਂ ਪਾਈਆਂ ਉਸ ਵਿੱਚ ਮੈਂ ਦੇਖਿਆ ਕਿ ਬੱਚੇ ਬਹੁਤ ਹੀ ਅੱਗੇ ਵੱਧ ਚੁੱਕੇ ਸੀ ਬੱਚਿਆਂ ਦਾ ਫੋਟੋਆਂ ਖਿੱਚਣ ਦਾ ਤਰੀਕਾ ਹੀ ਬੜਾ ਵਧੀਆ ਸੀਗਾ ਅੰਤਰਰਾਸ਼ਟਰੀ ਦਾ ਤਾਂ ਨਿਯਮ ਕਾਨੂੰਨ ਦਾ ਰੁਤਬਾ ਹੀ ਵੱਖਰਾ ਸੀ ਅੰਤਰਰਾਸ਼ਟਰੀ ਵਿੱਚ ਜਾਣ ਤੋਂ ਬਾਅਦ ਮੈਨੂੰ ਉਸ ਤੋਂ ਬੜਾ ਬੜਾ ਹੀ ਕੁਛ ਸਿੱਖਣ ਨੂੰ ਮਿਲਿਆ ਅੰਤਰਰਾਸ਼ਟਰੀ ਵਿੱਚ ਮੈਂ ਦੇਖਿਆ ਕਿ ਉਸ ਦਾ ਤਾਂ ਰੁਤਬਾ ਹੀ ਬੜਾ ਅਲੱਗ ਸੀ ਉਸ ਦਾ ਫੋਟੋਆਂ ਖਿੱਚਣ ਦਾ ਪੱਧਰ ਹੀ ਸਭ ਤੋਂ ਵੱਧ ਸੀ ਇਸ ਥਾਂ 'ਤੇ ਆ ਕੇ ਪਤਾ ਚੱਲਦਾ ਹੈ ਕਿ ਦੁਨੀਆਂ ਕਿੰਨੀ ਅੱਗੇ ਵੱਧ ਚੁੱਕੀ ਹੈ